ਹੈਲੋ ਸਤਿ ਸ਼੍ਰੀ ਅਕਾਲ

ਜੀ ਓਕੇ ਅ ਹਾਂਜੀ ਜਾਂ ਜਿੱਦਾਂ ਕਿ ਆਪਾਂ ਫੇਮਸ ਪਰਸਨੈਲਿਟੀ ਬਾਰੇ ਗੱਲ ਕੀਤੀ ਆ ਉਹਦੇ 'ਚ ਜਿੱਦਾਂ ਕਿ ਸਾਡੇ ਕਾਫ਼ੀ ਪਰਸਨੈਲਟਡ ਪਰਸਨ ਰਹੇ ਆ ਅ ਡਾਕਟਰ ਸਤਿੰਦਰ ਸਰਤਾਜ ਜੀ ਇੱਕ ਬਹੁਤ ਵਧੀਆ ਕਲਾਕਾਰ ਨੇ ਫ਼ਿਲਮ ਐਕਟਰ ਨੇ ਔਰ ਲੇਖਕ ਵੀ ਨੇ ਅੱਛੇ ਉਹ ਹੁਸ਼ਿਆਰਪੁਰ ਦੇ ਜੰਮਪਲ ਨੇ ਬਜਰਾਵਰ ਦੇ ਉਨ੍ਹਾਂ ਦਾ ਜਨਮ ਅਸਥਾਨ ਬਜਰਾਵਰ ਪਿੰਡ ਹੁਸ਼ਿਆਰਪੁਰ ਦਾ ਉੱਥੇ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਹੋਏ ਨੇ ਉੱਥੋਂ ਹੀ ਉਨ੍ਹਾਂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਿੱਖਿਆ ਪ੍ਰਾਪਤ ਕੀਤੀ ਫਿਰ ਉਸ ਤੋਂ ਬਾਅਦ ਜੋ ਕਿ ਗ੍ਰੇਜੁਏਸ਼ਨ ਦੀ ਗੱਲ ਕਰਦੇ ਪੋਸਟ ਗ੍ਰੇਜੁਏਸ਼ਨ ਦੀ ਉਹ ਗੌਮੈਂਟ ਕਾਲਜ ਹੁਸ਼ਿਆਰਪੁਰ ਤੋਂ ਉਨ੍ਹਾਂ ਨੇ ਆਪਣੀ ਗ੍ਰੇਜੁਏਸ਼ਨ ਸਾਰੀ ਕੰਪਲੀਟ ਕੀਤੀ ਆ ਇਹਦੇ ਮਿਊਜ਼ਿਕ ਵੋਕਲ ਦੇ ਵਿੱਚ ਹੈ ਨਾ ਅਤੇ ਉਹ ਬਹੁਤ ਵਧੀਆ ਫੇਮਸ ਕਲਾਕਾਰ ਨੇ ਆਪਣੇ ਇੰਟ ਇੰਟਰਨੈਸ਼ਨਲ ਕਲਾਕਾਰਾਂ ਦੇ ਵਿੱਚੋਂ ਇੱਕ ਨੇ ਔਰ ਬ ਬੜੇ ਅੱਛੇ ਪਰਸਨ ਨੇ ਜਿੱਦਾਂ ਕਿ ਅਸੀਂ ਕਿਤੇ ਹਾਂਜੀ ਅਤੇ ਹਾਂ ਜਿੱਦਾਂ ਕਿ ਫ਼ਿਲਮਾਂ ਜਿੱਦਾਂ ਕਿ ਪ ਮੈਂ ਹੋਰ ਦੱਸ ਦੇਵਾਂ ਇੱਕ ਵਿੱਕੀ ਕੌਸ਼ਲ ਬਹੁਤ ਵੱਡੇ ਫ਼ਿਲਮ ਇੰਡਸਟਰੀ ਦੇ ਵਿੱਚ ਨਾਮ ਆ ਉਨ੍ਹਾਂ ਦਾ ਵਿੱਕੀ ਕੌਸ਼ਲ ਦਾ ਬਹੁਤ ਫ਼ਿਲਮਾਂ ਕਰ ਚੁੱਕੇ ਨੇ ਉਹ ਵੀ ਹੁਸ਼ਿਆਰਪੁਰ ਤੋਂ ਹੀ ਨੇ ਦੂਜੇ ਕਿ ਸਾਡੇ ਬਹੁਤ ਹੀ ਪੁਰਾਣੇ ਫੇਮਸ ਐਕਟਰ ਅਮਰੀਸ਼ ਪੁਰੀ ਜੀ ਉਹ ਵੀ ਇੱਥੋਂ ਦੇ ਹੀ ਜੰਮਪਲ ਨੇ ਔਰ ਇੱਥੇ ਹੀ ਉਨ੍ਹਾਂ ਨੇ ਗੌਮੈਂਟ ਕਾਲਜ ਜੋ ਕਿ ਪਹਿਲਾਂ ਯੂਨੀਵਰਸਿਟੀ ਹੋਇਆ ਕਰਦੀ ਸੀਗੀ ਇੱਥੋਂ ਦੇ ਪੜ੍ਹੇ ਲਿਖੇ ਨੇ ਅਤੇ ਇੱਥੋਂ ਹੀ ਪੜ੍ਹ ਕੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਫਿਰ ਸਵਰਗਵਾਸ ਹੋ ਗਏ ਇੱਦਾਂ ਹੀ ਆਪਣੇ ਬਹੁਤ ਹੀ ਫੇਮਸ ਐਕਟਰ ਸ਼ਾਹਰੁਖ ਖਾਨ ਆ ਉਨ੍ਹਾਂ ਦੀ ਵਾਈਫ ਖਾਨ ਉਹ ਵੀ ਇੱਥੋਂ ਦੇ ਹੁਸ਼ਿਆਰਪੁਰ ਦੇ ਨੇ ਇੱਥੋਂ ਹੀ ਪੜ੍ਹ ਲਿਖ ਕੇ ਤੇ ਬਾਅਦ 'ਚੋਂ ਸ਼ਾਹਰੁਖ ਖਾਨ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੈ ਨਾ ਕਾਫ਼ੀ ਪਰਸਨ ਇੱਦਾਂ ਦੇ ਹੈਗੇ ਆ ਔਰ ਜਿੱਦਾਂ ਕਿ ਮੈਂ ਸਰਤਾਜ ਦੀ ਗੱਲ ਕਰਦਾ ਉਨ੍ਹਾਂ ਨੇ ਨਵੀਂ ਨਵੀਂ ਹੁਣ ਇੱਕ ਫ਼ਿਲਮ ਕੀਤੀ ਆ ਜਿਹੜੀ ਜਲਦੀ ਹੀ ਆਪਣੀ ਫ਼ਿਲਮ ਪ੍ਰੋਮੋਸ਼ਨ ਲਈ ਗੌਮੈਂਟ ਕਾਲਜ ਹੁਸ਼ਿਆਰਪੁਰ ਆ ਰਹੇ ਨੇ ਜੇ ਤੁਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਉਸ ਟੈਮ ਮਿਲ ਸਕਦੇ ਹੋ ਬਿਲਕੁਲ ਹਾਂ ਅਤੇ ਹਾਂਜੀ ਉਨ੍ਹਾਂ ਦੀ ਫ਼ਿਲਮ ਰਿਲੀਜ਼ ਹੋ ਰਹੀ ਹੈ ਸੱਤ ਮਾਰਚ ਨੂੰ ਉਹ ਸ਼ਾਇਦ ਮੇ ਬੀ ਛੇ ਮਾਰਚ ਨੂੰ ਅ ਹੁਸ਼ਿਆਰਪੁਰ ਆ ਰਹੇ ਨੇ ਉਨ੍ਹਾਂ ਅਤੇ ਉਹ ਉਸ ਟੈਮ ਤੁਸੀਂ ਉਨ੍ਹਾਂ ਨੂੰ ਮਿਲ ਸਕਦੇ ਹੋ ਅਤੇ ਰੂ ਬ ਰੂ ਹੋ ਸਕਦੇ ਹੋ ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਹੈ ਨਾ ਬਹੁਤ ਅੱਛੀ ਪਰਸਨੈਲਿਟੀ ਆ ਹਾਂ ਹਾਂ ਅਗਰ ਤੁਸੀਂ ਵਿਜ਼ਟਰ ਹੋ ਬਾਹਰੋਂ ਆਏ ਹੋ ਸ਼ਪੈਸ਼ਲੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹੋ ਗੌਮੈਂਟ ਕੋਲਜ ਦੇ ਪ੍ਰਿੰਸੀਪਲ ਮੈਮ ਨਾਲ ਤੁਸੀਂ ਇੱਕ ਵਾਰੀ ਗੱਲ ਕਰ ਲੈਣਾ ਕੋਲਜ ਦੇ ਵਿੱਚ ਵਿਜਿਟ ਕਰਨਾ ਉਨ੍ਹਾਂ ਤੋਂ ਟਾਈਮ ਲੈ ਲੈਣਾ ਉਹ ਤੁਹਾਨੂੰ ਮੇ ਬੀ ਟਾਈਮ ਦੇਣਗੇ ਜਿਸ ਹਿਸਾਬ ਨਾਲ ਹੈ ਨਾ ਉਹਦੇ ਅਕੋਡਿੰਗ ਤੁਸੀਂ ਉਨ੍ਹਾਂ ਨਾਲ ਉੱਥੇ ਬਹਿ ਕੇ ਗੱਲ ਬਾਤ ਕਰ ਸਕਦੇ ਹੋ ਸਰਤਾਜ ਜੀ ਨਾਲ ਜੋ ਵੀ ਤੁਹਾਡੇ ਮਤਲਬ ਕੋਸ਼ਚਨ ਹੋਣਗੇ ਉਨ੍ਹਾਂ ਨੂੰ ਪੁੱਟ ਕਰ ਸਕਦੇ ਹੋ ਕੋਈ ਵੀ ਗੱਲ ਬਾਤ ਤੁਸੀਂ ਅ ਐਜ ਏ ਫਰੈਂਡਲੀ ਕਰਨਾ ਚਾਹੁੰਦੇ ਹੋ ਉਨ੍ਹਾਂ ਨਾਲ ਉਹ ਵੀ ਤੁਸੀਂ ਕਰ ਸਕਦੇ ਹੋ ਉਨ੍ਹਾਂ ਦੀ ਫ਼ਿਲਮ ਹਜੇ ਨਵੀਂ ਲੱਗੀ ਆ ਅਤੇ ਸੌਰੀ ਮੈਂ ਨਾਮ ਨਹੀਂ ਨਾਮ ਭੁੱਲ ਗਿਆ ਹਾਂਜੀ ਅਤੇ ਓਕੇ ਮੇ ਬੀ ਤੁਸੀਂ ਸਰਚ ਕਰ ਲੈਣਾ ਹਾਂ ਤੁਹਾਨੂੰ ਉਹ ਫ਼ਿਲਮ ਬਾਰੇ ਉਹ ਸਾਰੀ ਅ ਦੱਸ ਦੇਣਗੇ ਗੱਲ ਬਾਤ ਸਾਰੀ ਜੋ ਵੀ ਹੈਗੀ ਆ ਹੈ ਨਾ ਕੋਈ ਵੀ ਗੱਲ ਕਰਨਾ ਚਾਹੁੰਦੇ ਤੁਸੀਂ ਉਹ ਤੁਹਾਨੂੰ ਬੜੇ ਅੱਛੇ ਹਾਂ ਅਤੇ ਉਹ ਬਹੁਤ ਹਾਂਜੀ ਹਾਂਜੀ ਜ਼ਰੂਰ ਮੈਮ ਜਦੋਂ ਜੀ ਬਿਲਕੁਲ ਜੀ ਬਿਲਕੁਲ ਕੋਲ ਕਰ ਸਕਦੇ ਹੋ ਤੁਸੀਂ ਠੀਕ ਠੀਕ ਹੈ ਥੈਂਕਿਊ ਥੈਂਕਿਊ ਮੈਮ ਓਕੇ ਜੀ